ਹੈਲੋ ਮੈਂ ਕੈਂਟ ਰੋਡ ਤੇ ਰਹਿਨਾ ਹਾਂ ਮੇਰਾ ਘਰ ਦੁਸ਼ਹਿਰਾ ਗਰਾਊਂਡ ਤੇ ਬਿਲਕੁਲ ਕੋਲ ਹੈ ਦੋ ਤਿੰਨ ਹੋਕ ਹੋ ਗਏ ਐ ਦੁਸ਼ਹਿਰਾ ਖਤਮ ਹੋਏ ਨੂੰ ਪਰ ਹਜੇ ਤੱਕ ਕੋਈ ਗਰਾਊਂਡ ਦੇ ਵਿੱਚ ਕੂੜਾ ਕਰਕਟ ਨਹੀਂ ਚੱਕਿਆ ਗਿਆ ਹੈ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕੂੜਾ ਚੁਕਵਾਓ ਤਾਂ ਜੋ ਸਫਾਈ ਹੋ ਸਕੇ ਅਤੇ ਬਿਮਾਰੀ ਜਾਂ ਬਿਮਾਰੀਆਂ ਤੋਂ ਬਚਾਅ ਹੋ ਸਕੇ ਧੰਨਵਾਦ